ਵੈਸੇ ਤਾਂ ਬਹੁਤ ਸਾਰੀਆਂ ਸੰਸਥਾਵਾਂ ਹਨ ਜੋ ਕਿ ਪੰਜਾਬ ਦੇ ਖੇਤੀਬਾੜੀ ਵਿਭਾਗ ਨੂੰ ਉੱਪਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਸਾਰਿਆਂ ਨਾਲੋਂ ਜ਼ਿਆਦਾ ਪੰਜਾਬ ਐਗਰੀਕਲਚਰ ਹੈ ਜੋ ਕਿ ਕਿਸਾਨਾਂ ਦੇ ਹੱਕ ਲਈ ਅਤੇ ਕਿਸਾਨਾਂ ਨੂੰ ਜਿੰਨਾ ਵੱਧ ਤੋਂ ਵੱਧ ਫਾਇਦਾ ਹੋਵੇ ਉਹਨਾਂ ਦੇ ਹੱਕ ਦੇ ਲਈ ਅੱਗੇ ਆ ਰਹੀ ਹੈ ਇਹ ਕਿਸਾਨਾਂ ਨੂੰ ਬਹੁਤ ਜ਼ਿਆਦਾ ਸੁਵਿਧਾਵਾਂ ਪ੍ਰੋਵਾਈਡ ਕਰਦੀ ਹੈ ਜਿਸ ਵਿੱਚ ਕਿ ਆਰਗੈਨਿਕ ਖੇਤੀ ਲਈ ਅਤੇ ਕਿਸਾਨਾਂ ਲਈ ਇਹ ਬੀਜ ਵਗੈਰਾ ਅਤੇ ਨਾਲ ਹੀ ਨਾਲ ਜੋ ਕਿਸਾਨ ਲਈ ਵਰਤੇ ਜਾਂਦੇ ਹਨ ਟੂਲ ਵਗੈਰਾ ਜੋ ਮਸ਼ੀਨਰੀ ਵਗੈਰਾ ਵਰਤਦੇ ਹਨ ਉਹਨਾਂ ਨੂੰ ਕਿਸਾਨਾਂ ਤੱਕ ਪਹੁੰਚਾਉਂਦੀ ਹੈ ਅਤੇ ਉਹਨਾਂ ਨੂੰ ਇਹ ਸਹੂਲਤਾਂ ਮੁਹੱਈਆ ਕਰਵਾਉਂਦੀ ਹੈ ਜਿਸ ਨਾਲ ਕਿ ਕਿਸਾਨਾਂ ਨੂੰ ਅੱਗੇ ਤੋਂ ਅੱਗੇ ਖੇਤੀ ਕਰਨ ਵਿੱਚ ਕੋਈ ਜ਼ਿਆਦਾ ਦਿੱਕਤ ਨਾ ਆਵੇ ਅਤੇ ਫਸਲ ਦੀ ਪੈਦਾਵਾਰ ਵਧੀਆ ਅਤੇ ਜ਼ਿਆਦਾ ਹੋਵੇ ਅਤੇ ਜਿਸ ਨਾਲ ਕਿਸਾਨਾਂ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਚੀਜ਼ ਦਾ ਵੱਧ ਤੋਂ ਵੱਧ ਫਾਇਦਾ ਹੋਵੇ ਇਸ ਲਈ ਇਹ ਸੰਸਥਾਵਾਂ ਪੰਜਾਬ ਦੇ ਲੋਕਾਂ ਲਈ ਅਤੇ ਕਿਸਾਨਾਂ ਲਈ ਬਹੁਤ ਜ਼ਿਆਦਾ ਲਾਭਦਾਇਕ ਅਤੇ ਫਾਇਦੇਮੰਦ ਹਨ ਇਹ ਕਿਸਾਨਾਂ ਦੇ ਹੱਕ ਲਈ ਵੀ ਖੜ੍ਹਦੀਆਂ ਹਨ ਅਤੇ ਨਾਲ ਹੀ ਨਾਲ ਇਹਨਾਂ ਦੇ ਕਈ ਥਾਵਾਂ 'ਤੇ ਆਪਣੀ ਆਪਣੀਆਂ ਬਰਾਂਚਾਂ ਵੀ ਹੁੰਦੀਆਂ ਹਨ ਜੋ ਕਿ ੲਜ ਇਹ ਜੋ ਕਿ ਹਰੇਕ ਥਾਂ ਹਰੇਕ ਥਾਂ 'ਤੇ ਹਰੇਕ ਕਿਸਾਨ ਦੀ ਮਦਦ ਕਰਨ ਲਈ ਤਿਆਰ ਰਹਿੰਦੀਆਂ ਹਨ ਇਹ ਕਿਸਾਨਾਂ ਨੂੰ ਨਵੀਂ ਨਵੀਂ ਔਰਗੈਨਿਕ ਖੇਤੀ ਲਈ ਦੱਸਦੀਆਂ ਹਨ ਅਤੇ ਜੋ ਵੀ ਇਹ ਖਾਦ ਵਗੈਰਾ ਹੁੰਦੀ ਹੈ ਖਾਦ ਬੀਜ ਵਗੈਰਾ ਹੁੰਦੇ ਹਨ ਉਹਨਾਂ ਨੂੰ ਸਬਸਿਡੀ ਉਹਨੂੰ ਸਬਸਿਡੀ ਵੀ ਮਿਲਦੀ ਹੈ ਇਹਨਾਂ ਚੀਜ਼ਾਂ 'ਤੇ ਇਸ ਲਈ ਇਹ ਸੰਸਥਾਵਾਂ ਇਹ ਸੰਸਥਾਵਾਂ ਪੰਜਾਬ ਵਿੱਚ ਮਾਨਤਾ ਪ੍ਰਾਪਤ ਵੀ ਹਨ